ਮੇਰਾ ਮਨਪਸੰਦ ਜਿਹੜਾ ਮੌਸਮ ਹੈ ਨਾ ਉਹ ਹੈਗਾ ਹੈ ਵੀ ਜਿੱਦਾਂ ਜਿਹਦੇ ਵਿੱਚ ਗਰਮੀ ਵੀ ਬਹੁਤੀ ਤੇਜ ਨਾ ਹੋਵੇ ਠੰਡ ਵੀ ਬਹੁਤੀ ਨਾ ਹੋਵੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਤਾਂ ਮਾਰਚ ਐਪਰਲ ਸਪਟੰਬਰ ਅਕਤੂਬਰ ਇਹ ਮੌਸਮ ਤਕਰੀਬਨ ਠੀਕ ਹੈ ਕਿਉਂਕਿ ਇਹਦੇ ਵਿੱਚ ਮਤਲਬ ਠੰਡ ਵੀ ਨਹੀਂ ਹੁੰਦੀ ਅਤੇ ਗਰਮੀ ਵੀ ਨਹੀਂ ਹੁੰਦੀ ਇਸ ਕਰਕੇ ਇਹ ਮੌਸਮ ਠੀਕ ਹੈ ਮੈਨੂੰ ਪਸੰਦ ਹੈ ਓਕੇ